ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਨਹੀਂ ਕਿਆ ਮੈਂ ਤੁਹਾਡਾ ਨਾਂ ਜਾਣ ਸਕਦਾ ਜੀ ਯੇਸ ਓਕੇ ਠੀਕ ਹੈ ਜੀ ਹਾਂਜੀ ਤੁਸੀਂ ਆਪਣਾ ਸਟੱਡੀ ਦਾ ਬੈਕਗਰਾਉਂਡ ਦੱਸ ਸਕਦੇ ਹੋ ਓਕੇ ਜੀ ਦੇਖੋ ਲਖਬੀਰ ਸਿੰਘ ਜੀ ਇਹਦੇ ਵਿੱਚ ਦੋ ਗੱਲਾਂ ਬਹੁਤ ਜ਼ਿਆਦਾ ਮਾਈਨੇ ਰਖਾਂਦੀਆਂ ਫਸਟ ਵਨ ਯੂਅਰ ਇੰਟਰਸਟ ਐਂਡ ਸੈਕਿੰਡ ਵਨ ਯੂਅਰ ਫੈਮਿਲੀ ਬੈਕਗਰਾਊਂਡ ਤੁਹਾਡਾ ਕਿਸ ਫੀਲਡ ਦੇ ਵਿੱਚ ਇੰਟਰਸਟ ਹੈ ਤੁਸੀਂ ਟੈਂਨਥ ਕੀਤੀ ਟੈਂਨਥ ਤੋਂ ਬਾਅਦ ਤੁਸੀਂ ਸਬਜੈਕਟ ਚੂਜ ਕੀਤੇ ਪਲੱਸ ਵਨ ਪਲੱਸ ਟੂ ਦੇ ਵਿੱਚ ਤੁਸੀਂ ਆਰਟਸ ਫ਼ੀਲਡ ਚੂਜ ਕੀਤੀ ਆਰਟਸ ਆਰਟਸ ਸਟ੍ਰੀਮ ਤੁਸੀਂ ਚੂਜ ਕੀਤਾ ਕਿਸ ਬੇਸ ਨੂੰ ਚੂਜ ਰੱਖ ਕੇ ਚੂਜ ਕੀਤਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਫੈਮਿਲੀ ਬੈਕਗਰਾਊਂਡ ਸੀਗਾ ਉਹ ਕਿਸ ਤਰ੍ਹਾਂ ਦਾ ਤੁਹਾਡੀ ਆਰਥਿਕ ਸਥਿੱਤੀ ਤੁਹਾਡੀ ਇੰਨਕਮ ਕਿਸ ਤਰਾਂ ਦੀ ਹੈਗੀ ਉਸ ਹਿਸਾਬ ਦੇ ਨਾਲ ਆਪਾਂ ਜਿਹੜਾ ਕੈਰੀਅਰ ਦੇਸ਼ ਦੇ ਵਿੱਚ ਚੂਜ ਕਰਨਾ ਪੈਂਦਾ ਸਾਨੂੰ ਅਗਰ ਅਸੀਂ ਹਵਾ ਦੇ ਵਿੱਚ ਉੱਡ ਕੇ ਕਿਸੇ ਦੇ ਮਗਰ ਲੱਗ ਕੇ ਕਿਸੇ ਹੋਰ ਸਟੂਡੈਂਟ ਦੇ ਮਗਰ ਲੱਗ ਕੇ ਕਿਸੇ ਹੋਰ ਕਿਸੇ ਤੀਜੇ ਬੰਦੇ ਦੇ ਮਗਰ ਲੱਗ ਕੇ ਆਪਣਾ ਕੈਰੀਅਰ ਉਹਦੇ ਮੁਤਾਬਕ ਆਪਣੇ ਇੰਟਰਸਟ ਨੂੰ ਜਾਣੇ ਬਗੈਰ ਆਪਣੇ ਇੰਟਰਸਟ ਨੂੰ ਆਪਣੀਆਂ ਹੋਬੀਜ਼ ਨੂੰ ਜਾਂ ਆਪਣੀ ਇੰਟੈਲੀਜੈਂਸੀ ਨੂੰ ਪਰਖੇ ਵਗੈਰਾ ਜਦੋਂ ਆਪਾਂ ਚੂਜ ਕਰਦੇ ਤਾਂ ਉਸ ਵਕਤ ਕਿ ਸਾਨੂੰ ਫਿਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਪਰ ਮੈਂ ਇਹ ਗੱਲ ਸਮਝਦਾ ਵੀ ਕਿਸੇ ਵੀ ਫੀਲਡ ਦੇ ਵਿੱਚ ਅਗਰ ਕਿਸੇ ਦਾ ਇੰਟਰਸਟ ਹੈ ਤਾਂ ਉਹਨੂੰ ਕਾਮਯਾਬੀ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਜਿਹਦੇ ਵਿੱਚ ਨੋਬੋਡੀ ਹੂ ਕੈਨ ਸਟੋਪ ਦ ਪਰਸਨ ਇਫ ਸ਼ੀ ਵਾਂਟ ਹੀ ਔਰ ਸ਼ੀ ਵਾਂਟ ਟੂ ਸੁਕਸੱਸ ਇੰਨ ਹਿਜ ਹਰ ਔਰ ਹਰ ਲਾਈਫ ਸੋ ਫਾਸਟ ਵਨ ਅਗਰ ਤੁਸੀਂ ਆਰਟਸ ਫ਼ੀਲਡ ਚੁਣੀ ਹੈ ਤਾਂ ਆਰਟਸ ਫ਼ੀਲਡ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਜਿਹੜੇ ਰਸਤੇ ਸਾਨੂੰ ਨਿਕਲ ਕੇ ਸਾਹਮਣਾ ਆਉਂਦੇ ਸਭ ਤੋਂ ਪਹਿਲਾਂ ਸਿੰਪਲ ਗ੍ਰੈਜੂਏਸ਼ਨ ਹੁੰਦੀ ਸਿੰਪਲ ਗ੍ਰੈਜੂਏਸ਼ਨ ਦੇ ਦੌਰਾਨ ਤੁਸੀਂ ਕਿਆ ਕਰ ਸਕਦੇ ਕਿਸੇ ਵਧੀਆ ਪੇਪਰ ਦੀ ਤਿਆਰੀ ਕਰ ਸਕਦੇ ਨਾਲ ਦੀ ਨਾਲ ਅਗਰ ਤੁਸੀਂ ਗੌਰਮੈਂਟ ਜੋਬ ਦੇ ਵਿੱਚ ਜਾਣਾ ਚਾਹੁੰਦੇ ਇਹ ਵੀ ਇੰਟਰਸਟ ਕਿਆ ਤੁਹਾਡਾ ਗੋਰਮੈਂਟ ਜੋਬ ਦੇ ਵਿੱਚ ਇੰਟਰਸਟ ਹੈ ਓਕੇ ਅਗਰ ਜ਼ਰੂਰੀ ਹੈ ਤਾਂ ਤੁਸੀਂ ਜਿਵੇਂ ਟੈਂਨਥ ਦੇ ਬੇਸ 'ਤੇ ਜਾਂ ਪਲੱਸ ਟੂ ਦੇ ਬੇਸ 'ਤੇ ਐਸ ਐਸ ਸੀ ਦਾ ਪੇਪਰ ਹੁੰਦਾ ਉਹਦੇ ਨਾਲ ਨਾਲ ਤੁਸੀਂ ਆਪਦੀ ਸਟੱਡੀ ਜਾਰੀ ਕਰ ਸਕਦੇ ਔਰ ਉਸ ਪੇਪਰ ਦੀ ਇੱਕ ਸਾਲ ਦੇ ਵਿੱਚ ਪ੍ਰਿਪਰੇਸ਼ਨ ਕਰਕੇ ਤੁਸੀਂ ਉਹ ਪੇਪਰ ਨੂੰ ਕੱਢ ਕੇ ਵਧੀਆ ਕਿਸੇ ਸੈਂਟਰ ਗੋਰਮੈਂਟ ਦੀ ਜੋਬ 'ਤੇ ਅਪੁਆਇੰਟ ਹੋ ਸਕਦੇ ਜਿਹਦੇ ਨਾਲ ਕਿਆ ਤੁਹਾਡੀ ਜਿਹੜੇ ਬੇਸਿਕ ਨੀਡ ਆ ਜਾਂ ਤੁਹਾਡਾ ਜਿਹੜਾ ਇੱਕ ਜ਼ਿੰਦਗੀ ਦਾ ਇੱਕ ਨੌਕਰੀ ਲੈਣ ਦਾ ਬਰਡਨ ਹੈ ਉਹ ਕਿਆ ਜਾਊਗਾ ਬਹੁਤ ਵੱਡਾ ਲਹਿ ਜਾਊਗਾ ਉਸਦੇ ਨਾਲ ਨਾਲ ਤੁਸੀਂ ਆਰਟਸ ਫ਼ੀਲਡ ਦੇ ਵਿੱਚ ਆਪਣੀ ਸਟੱਡੀ ਕਰਕੇ ਅੱਗੇ ਸਿੰਪਲ ਗਰੈਜੂਏਸ਼ਨ ਬੀ ਏ ਤੋਂ ਬਾਅਦ ਸਿਰਫ਼ ਚਾਲੀ ਪਰਸੈਂਟ ਬੀ ਏ ਤੋਂ ਬਾਅਦ ਤੁਸੀਂ ਕਿਹਾ ਹੈ ਯੂ ਪੀ ਐਸ ਸੀ ਪੀ ਸੀ ਐਸ ਦੇ ਪੇਪਰਾਂ ਵੱਲ ਤੁਸੀਂ ਆਪਣਾ ਜਿਹੜਾ ਫੋਕਸ ਕਰ ਸਕਦੇ ਅਗਰ ਤੁਸੀਂ ਐਜ਼ ਏ ਔਫੀਸਰ ਐਜ ਏ ਬਿਊਰੋਕਰੈਟ ਤੁਸੀਂ ਇਸ ਦੇਸ਼ ਦੇ ਵਿੱਚ ਕੰਮ ਕਰਨਾ ਚਾਹੁੰਦੇ ਉਸ ਚੀਜ਼ ਤੋਂ ਇਲਾਵਾ ਅਗਰ ਤੁਸੀਂ ਹਾਇਰ ਐਜੂਕੇਸ਼ਨ ਵਿੱਚ ਜਾਣਾ ਚਾਹੁੰਦੇ ਤਾਂ ਸਿੰਪਲ ਗ੍ਰੈਜੂਏਸ਼ਨ ਮਾਸਟਰ ਦੀ ਪੜ੍ਹਾਈ ਕਰਕੇ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਫੀਲਡ ਨੂੰ ਅੱਗੇ ਨੇ ਸਕਦੇ ਪੀ ਐਚ ਡੀ ਲੈਵਲ ਤੱਕ ਜਾਂ ਹੋਰ ਫੀਲਡ ਤੱਕ ਸੋ ਬਹੁਤ ਸਾਰੇ ਰਾਸਤੇ ਜਿਹੜੇ ਤੁਸੀਂ ਖੋਲ੍ਹ ਸਕਦੇ ਪਰ ਹੁਣ ਸਮੇਂ ਦਾ ਧਿਆਨ ਰੱਖ ਕੇ ਆਪਾਂ ਆਪਣੀ ਗੱਲ ਇੱਥੇ ਬੰਦ ਕਰਾਂਗੇ ਬੋਲੋ ਫਤਿਹ ਬੁਲਾਓ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ